ਹੈਲੋ ਕੀ ਤੁਸੀਂ ਸਰਦਾਰ ਟ੍ਰੈਵਲਜ਼ ਤੋਂ ਗੱਲ ਕਰ ਰਹੇ ਹੋ ਮੈਂ ਹਰਮਨ ਕੌਰ ਕੱਲ੍ਹ ਤੁਹਾਡੀ ਏਜੰਸੀ ਦੇ ਵਿੱਚ ਕੌਲ ਕਰਕੇ ਰੋਪੜ ਤੋਂ ਚੰਡੀਗੜ੍ਹ ਜਾਣ ਲਈ ਇੱਕ ਕੈਬ ਬੁੱਕ ਕੀਤੀ ਸੀ ਅਤੇ ਉਸ ਸਮੇਂ ਮੈਨੂੰ ਕਿਰਾਇਆ ਅੱਠ ਸੌ ਦੱਸਿਆ ਗਿਆ ਸੀ ਪਰੰਤੂ ਇਸ ਸਮੇਂ ਡਰਾਈਵਰ ਮੈਤੋਂ ਵੱਧ ਕਿਰਾਏ ਦੀ ਮੰਗ ਕਰ ਰਿਹਾ ਹੈ ਜੋ ਕਿ ਗਿਆਰ੍ਹਾਂ ਸੌ ਹੈ ਅਤੇ ਮੈਂ ਅੱਠ ਸੌ ਹੀ ਕਿਰਾਇਆ ਦੇਵਾਂਗੀ ਕਿਉਂਕਿ ਪਹਿਲਾਂ ਹੀ ਮੇਰੇ ਨਾਲ ਉ ਗੱਲ ਨਿਸ਼ਚਿਤ ਹੋ ਚੁੱਕੀ ਸੀ ਕਿਰਪਾ ਕਰਕੇ ਤੁਸੀਂ ਆਪਣੇ ਡਰਾਈਵਰ ਨੂੰ ਕੌਲ ਕਰਕੇ ਸਮਝਾਓ ਮੈਂ ਇ ਅੱਠ ਸੌ ਰੁਪਏ ਕਿਰਾਇਆ ਹੀ ਦੇਵਾਂਗੀ ਅਤੇ ਇਸ ਤੋਂ ਵੱਧ ਨਹੀਂ ਦੇਵਾਂਗੀ ਧੰਨਵਾਦ